ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦੀਦੀ ਠੀਕ ਹੈ ਜੀ ਵਧੀਆ ਹੋਰ ਤੁਸੀਂ ਦੱਸੋ ਠੀਕ ਹੋ ਕੁਛ ਨਹੀਂ ਬਸ ਹਾਂ ਬਠਿੰਡੇ ਜਾ ਕੇ ਆਈ ਸੀਗੀ ਜੀ ਅੱਜ ਕੰਮ ਸੀ ਥੋੜ੍ਹਾ ਜਿਹਾ ਹਾਂਜੀ ਹਾਂਜ ਉੱਥੇ ਇੰਨੀ ਭੀੜ ਸੀ ਬਹੁਤ ਜ਼ਿਆਦਾ ਟਰੈਫਿਕ ਸੀ ਬਹੁਤ ਮੁਸ਼ਕਿਲ ਹੋਈ ਹਾਂਜੀ ਹਾਂ ਇੰਨੀ ਟਰੈਫਿਕ ਹੁੰਦੀ ਹੈ ਗੱਡੀ ਨੂੰ ਲੰਘਾਉਣ ਨੂੰ ਟਾਈਮ ਵੀ ਬਹੁਤ ਲੱਗ ਜਾਂਦਾ ਇੱਕ ਗਰਮੀ ਬਹੁਤ ਜ਼ਿਆਦਾ ਹੈ ਹਾਂ ਤਾਂ ਕਰਕੇ ਹਾਂਜੀ ਹਾਂਜੀ ਹਾਂ ਸਹੀ ਗੱਲ ਹੈ ਜੀ ਹਾਂ ਜੀ ਹਾਂ ਫਿਰ ਉਹ ਵਿੱਚੋਂ ਦੀ ਹਾਂਜੀ ਜਦੋਂ ਇੱਕ ਜਗ੍ਹਾ 'ਤੇ ਸਾਰੇ ਸਾਧਨ ਖੜੇ ਰਹਿੰਦੇ ਫਿਰ ਇੱਕ ਦਮ ਜਦੋਂ ਤੁਰਦੇ ਆ ਫਿਰ ਉਹ ਜ਼ਿਆਦਾ ਹੋ ਜਾਂਦਾ ਜੀ ਪ੍ਰਦੂਸ਼ਣ ਹਾਂ ਹਾਂਜੀ ਹਾਂ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਉੱਧਰੋਂ ਵਿੱਚੇ ਬੱਸਾਂ ਖੜੀਆਂ ਹੁੰਦੀਆਂ ਵਿੱਚੇ ਸਕੂਟਰ ਸਾਰਾ ਕੁਛ ਜੀ ਹਾਂ ਹਾਂ ਹਾਂ ਸਹੀ ਗੱਲ ਹੈ ਜੀ ਪੈਦਲ ਵਾਲਿਆਂ ਨੂੰ ਤਾਂ ਬਹੁਤ ਔਖਾ ਹੋ ਜਾਂਦਾ ਹਾਂ ਹਾਂ ਹਾਂਜੀ ਹਾਂ ਹਾਂਜੀ ਹਾਂ ਤਾਂ ਹੀ ਲੈਟ ਇੰਨੀ ਜਾਂਦੀ ਹੈ ਹਾਂ ਤਾਂ ਕਰਕੇ ਹੋਰ ਚਲੋ ਠੀਕ ਹੈ ਜੀ ਕੋਈ ਤਾਂ ਹੱਲ ਨਿਕਲੂਗਾ ਇਹਦੇ ਬਾਰੇ ਹਾਂ ਹਾਂ ਸਹੀ ਗੱਲ ਹੈ ਜੀ ਆਪਾਂ ਤਾਂ ਹੁਣ ਪਿੰਡਾਂ 'ਚ ਬੈਠੇ ਹਾਂ ਨਾ ਜਿਹੜੇ ਸ਼ਹਿਰਾਂ ਵਾਲੇ ਉਹਨਾਂ ਨੂੰ ਵੀ ਹਾਂ ਸ਼ਹਿਰਾਂ ਹਾਂ ਸ਼ਹਿਰਾਂ ਵਾਲਿਆਂ ਨੂੰ ਬਹੁਤ ਔਖਾ ਹਾਂ ਹਾਂ ਸਹੀ ਗੱਲ ਹੈ ਜੀ ਹੋਰ ਚਲੋ ਠੀਕ ਹੈ ਜੀ ਠੀਕ ਹੈ ਠੀਕ ਹੈ